ਪੰਜਾਬੀ ਲੋਕ ਗੀਤ ਇੱਥੋਂ ਦੇ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਨੂੰ ਦਰਸਾਉਂਦੇ ਹਨ ਕਿਉਂਕਿ ਵਿਆਹ ਸ਼ਾਦੀਆਂ ਵਿੱਚ ਜ਼ਿਆਦਾਤਰ ਜਿਹੜੀਆਂ ਪੁਰਾਣੀਆਂ ਬੁੱਢੀਆਂ ਹਨ ਉਹ ਲੋਕ ਗੀਤਾਂ ਨੂੰ ਗਾਉਂਦੀਆਂ ਹਨ ਅਤੇ ਵਿਆਹਾਂ ਵਿੱਚ ਉਨ੍ਹਾਂ ਪੁਰਾਣੀਆਂ ਬੁੱਢੀਆਂ ਹੀ ਜਾਣਦੀਆਂ ਹਨ ਇਹਨਾਂ ਨੂੰ ਸੁਰੱਖਿਅਤ ਰੱਖਣ ਅਤੇ ਮਸ਼ਹੂਰ ਕਰਨ ਲਈ ਸਾਨੂੰ ਵਿਆਹ ਸ਼ਾਦੀਆਂ ਵਿੱਚ ਪੁਰਾਣੇ ਲੋਕ ਗੀਤ ਹੀ ਗਾਉਣੇ ਚਾਹੀਦੇ ਹਨ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਪੰਜਾਬੀ ਲੋਕ ਗੀਤਾਂ ਬਾਰੇ ਕੋਈ ਜਾਣਕਾਰੀ ਨਹੀਂ ਸਾਨੂੰ ਅੱਜ ਦੀ ਪੀੜ੍ਹੀ ਨੂੰ ਲੋਕ ਗੀਤਾਂ ਬਾਰੇ ਜਾਣਕਾਰੀ ਦੇਣ ਲਈ ਵਿਆਹ ਸ਼ਾਦੀਆਂ ਵਿੱਚ ਡੀਜਿਆਂ ਦਾ ਪ੍ਰਬੰਧ ਨਹੀਂ ਕਰਨਾ ਚਾਹੀਦਾ ਉਨ੍ਹਾਂ ਨੂੰ ਲੋਕ ਗੀਤਾਂ ਦੇ ਬਾਰੇ ਜਾਣਕਾਰੀ ਦੇਣ ਲਈ ਵਿਆਹ ਸ਼ਾਦੀਆਂ ਵਿੱਚ ਪੁਰਾਣੇ ਲੋਕ ਗੀਤ ਹੀ ਗਾਉਣੇ ਚਾਹੀਦੇ ਹਨ ਉਨ੍ਹਾਂ ਨੂੰ ਸੁਰਕਸ਼ਿਤ ਰੱਖਣ ਲਈ ਸਕੂਲਾਂ ਵਿੱਚ ਵੀ ਜਿਵੇਂ ਦੂਜੇ ਕੋਂਪੀਟੀਸ਼ਨ ਹੁੰਦੇ ਹਨ ਉਸ ਪ੍ਰਕਾਰ ਰੱਖਣੇ ਚਾਹੀਦੇ ਹਨ